ਹਾਂਜੀ ਪੇਡੂ ਖੇਤਰ ਦੇ ਵਿੱਚ ਜੋ ਇਹ ਜੀਵਨ ਸਾਥੀ ਪ੍ਰਾਪਤ ਕਰਨ ਦੀ ਬਹੁਤ ਸਮੱਸਿਆਵਾਂ ਆ ਰਹੀਆਂ ਨੇ ਇਹਦੇ ਲਈ ਕਈ ਕਾਰਨ ਇਹ ਹਨ ਕਿ ਜਿਵੇਂ ਟੈਕਨੋਲੋਜੀ ਜਿਵੇਂ ਇਸ਼ਕੀ ਸ਼ਹਿਰਾਂ ਦੇ ਵਿੱਚ ਜੋ ਹੈ ਲੋਕ ਗੈਸ ਵਗੈਰਾ ਯੂਜ਼ ਕਰਦੇ ਨੇ ਪਿੰਡਾਂ ਦੇ ਵਿੱਚ ਹਾਲੇ ਵੀ ਬਹੁਤ ਥਾਂ ਚੁੱਲ੍ਹੇ ਯੂਜ਼ ਹੋ ਰਹੇ ਨੇ ਠੀਕ ਹੈ ਇਸ ਤੋਂ ਇਲਾਵਾ ਜੋ ਹੈ ਹੋਸਪਿਟਲ ਵਗੈਰਾ ਸ਼ਹਿਰਾਂ ਦੇ ਵਿੱਚ ਬਹੁਤ ਵਧੀਆ ਫੈਸਿਲਿਟੀਆਂ ਹਨ ਅਤੇ ਪ ਅ ਪਿੰਡ ਦੇ ਇਲਾਕਿਆਂ 'ਚ ਅਤੇ ਉਹੀ ਸਿਰਫ ਇੱਕ ਅ ਸਰਕਾਰੀ ਹਸਪਤਾਲ ਹੁੰਦਾ ਉਹ 'ਚ ਵੀ ਕਈ ਵਾਰੀ ਡਾਕਟਰ ਮਿਲਦੇ ਨੇ ਅਤੇ ਨਹੀਂ ਮਿਲਦੇ ਤੀਸਰੀ ਹੈ ਕਿ ਜਿਵੇਂ ਸਿੱਖਿਆ ਪ੍ਰਣਾਲੀ ਹੈ ਸਿੱਖਿਆ ਪ੍ਰਣਾਲੀ ਜਿਵੇਂ ਤੁਹਾਨੂੰ ਸ਼ਹਿਰਾਂ ਦੇ ਵਿੱਚ ਬਹੁਤ ਹੀ ਵਧੀਆ ਮਿਲ ਜਾਂਦੀ ਹੈ ਅਤੇ ਪਿੰਡ ਦੇ ਵਿੱਚ ਉਹ ਚੀਜ਼ ਨਹੀਂ ਮਿਲਦੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਵੇਂ ਕਿ ਅ ਆਉਣ ਜਾਣਾ ਪਿੰਡ ਦੇ ਵਿੱਚ ਅਤੇ ਤੁਹਾਨੂੰ ਪਿੰਡੋਂ ਬਾਹਰ ਨਿਕਲਣ ਲੱਗੇ ਕਿੰਨੀ ਦੂਰ ਆ ਕੇ ਤੁਹਾਨੂੰ ਪੈਦਲ ਹੀ ਚੱਲਣਾ ਪੈਂਦਾ ਹੈ ਜੇ ਤੁਸੀਂ ਕਿਤੇ ਜਾਣਾ ਵੀ ਹੈ ਲੇਕਿਨ ਸ਼ਹਿਰ ਦੇ ਵਿੱਚ ਜੇ ਤੁਸੀਂ ਨਿਕਲਦੇ ਤੁਹਾਨੂੰ ਬਾਹਰ ਹੀ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਤੁਸੀਂ ਆਰਾਮ ਦੇ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਜਾ ਸਕਦੇ ਹੋ ਇਸ ਤੋਂ ਇਲਾਵਾ ਦੇਖੋ ਹੁਣ ਜੇ ਪਿੰਡ ਦ ਖੇਤਰ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਵੀ ਹੈ ਅਤੇ ਪਰ ਉਹ ਚੰਗੀ ਤਨਖਾਹ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਚਲੋ ਤੁਸੀਂ ਜੋਬ ਜੋਬ ਫੈਸਲਿਟੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਂਦੀ ਹੈ ਜੇਕਰ ਤੁਸੀਂ ਇੱਕ ਜੋਬ ਤੋਂ ਅ ਸੈਟਿਸਫਾਈਡ ਨਹੀਂ ਹੋ ਤੁਸੀਂ ਦੂਸਰੀ ਜੋਬ ਕਰ ਸਕਦੇ ਹੋ ਲੇਕਿਨ ਪਿੰਡ ਦੇ ਵਿੱਚ ਇਹੋ ਜਿਹੀ ਕੋਈ ਵੀ ਫੈਸਿਲਿਟੀ ਨਹੀਂ ਮਿਲਦੀ ਜੇਕਰ ਇੱਕ ਇੱਕ ਥਾਂ ਤੁਸੀਂ ਜੋਬ ਕਰ ਰਹੇ ਹੋ ਅਤੇ ਤੁਸੀਂ ਸੈਟਿਸਫਾਈਡ ਨਹੀਂ ਹੋ ਕਈ ਵਾਰੀ ਤਾਂ ਤੁਹਾਨੂੰ ਉਹ ਜੋਬ ਕਰਨੀ ਹੀ ਪੈਂਦੀ ਹੈ